ਜਾਨਵਰਾਂ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਕੁਝ ਆਮ ਤਰੀਕੇ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਬੱਕਰੀ ਪਾਲਣ ਦਾ ਧੰਦਾ ਪ੍ਰਚੱਲਿਤ ਹੈ ਉਸ ਦੇ ਵਿੱਚ ਇੱਕ ਫਾਰਮ ਕੁਝ ਕੁ ਕੁਝ ਛੋਟੇ ਕਿਸਾਨ ਜਾਂ ਕੁਝ ਕੁ ਆਦਮੀ ਬੱਕਰੀਆਂ ਰੱਖਦੇ ਨੇ ਅਤੇ ਉਹ ਬੱਕਰੀਆਂ ਤਾਂ ਕਰਕੇ ਰੱਖਦੇ ਨੇ ਤਾਂ ਜੋ ਉਹ ਉਹਨਾਂ ਨੂੰ ਇਸ ਤੋਂ ਬਾਅਦ ਉਹਨਾਂ ਨੂੰ ਵੱਢ ਕੇ ਕੱਟ ਕੇ ਉਹਨਾਂ ਦਾ ਮੀਟ ਵੇਚਿਆ ਜਾ ਸਕੇ ਅਤੇ ਕੁਝ ਕੁ ਇਸ ਤਰ੍ਹਾਂ ਰੱਖਦੇ ਨੇ ਕਿ ਉਹਨਾਂ ਦੇ ਜੋ ਕਿ ਬ ਉਹ ਦੁੱਧ ਦੇਣ ਦੇ ਕੰਮ ਆ ਸਕਣ ਅਤੇ ਜੋ ਬੱਕਰੀਆਂ ਨੂੰ ਕੱਟਿਆ ਵੱਢਿਆ ਜਾਂਦਾ ਉਹ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਸਹੀ ਤਰੀਕੇ ਨਾਲ ਨਹੀਂ ਲਿਆ ਜਾਂਦਾ ਹੈਗਾ ਕਿਉਂਕਿ ਨਾ ਤਾਂ ਬੱਕਰੀਆਂ ਦੀ ਕੋਈ ਵੈਕਸੀਨ ਕੀਤੀ ਜਾਂਦੀ ਹੈ ਅਤੇ ਨਾ ਹੀ ਉਹਨਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਜਦੋਂ ਕੱਟ ਕਿਸੇ ਕਿਸੇ ਕਸਾਈ ਆਮ ਕਸਾਈ ਵੱਲੋਂ ਕੱਟ ਦਿੱਤੀਆਂ ਜਾਂਦੀਆਂ ਨੇ ਅਤੇ ਦੋ ਚਾਰ ਦਿਨਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਵੇਚ ਦਿੱਤਾ ਜਾਂਦਾ ਅਤੇ ਉਹੀ ਮੀਟ ਕਿਸੇ ਵਿਆਹ ਸ਼ਾਦੀ ਵਿੱਚ ਚਲਾ ਜਾਂਦਾ ਤਾਂ ਉਹ ਜ਼ਿਆਦਾ ਖਾਣ ਦੇ ਲਾਇਕ ਆਪਾਂ ਨਹੀਂ ਸਮਝ ਸਕਦੇ ਕਿਉਂਕਿ ਉਹਨਾਂ ਦੀ ਨਾ ਤਾਂ ਕੋਈ ਟੈਸਟਿੰਗ ਕੀਤੀ ਹੁੰਦੀ ਹੈ ਅਤੇ ਨਾ ਹੀ ਜਿਉਂਦੀ ਬੱਕਰੀਆਂ ਦੇ ਕੋਈ ਵੈਕਸੀਨ ਕੀਤੀ ਹੁੰਦੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਚੇਚੇ ਕਦਮ ਚੁੱਕਣੇ ਚਾਹੀਦੇ ਨੇ ਅਤੇ ਜੋ ਕਿ ਕੋਈ ਛੋਟਾ ਕਸਾਈ ਹੈ ਚਾਹੇ ਜੇ ਕੋਈ ਬੱਕਰੀ ਪਾਲਣ ਕਿਸਾਨ ਹੈ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇ ਅਤੇ ਉਹਨਾਂ ਦੀ ਵੈਕਸਿੰਨ ਸਮੇਂ ਸਮੇਂ ਸਿਰ ਕਰਵਾਈ ਜਾਵੇ ਤਾਂ ਜੋ ਬੱਕਰੀ ਪਾਲਣ ਦੇ ਧੰਦੇ 'ਤੇ ਆਪਣਾ ਉਤਪਾਦ ਦੀ ਗੁਣਵੱਤਾ ਨੂੰ ਚੰਗੇ ਤਰੀਕੇ ਵਿੱਚ ਸ਼ਾਮਿਲ ਕੀਤਾ ਜਾ ਸਕੇ ਧੰਨਵਾਦ